ਸਤਿ ਸ਼੍ਰੀ ਅਕਾਲ ਜੀ ਮੈਂ ਪਟਿਆਲਾ ਜ਼ਿਲ੍ਹੇ ਦਾ ਵਸਨੀਕ ਹਾਂ ਇੱਥੇ ਮਹੱਤਵਪੂਰਨ ਧਾਰਮਿਕ ਸਥਾਨਾਂ ਵਿੱਚ ਗੁਰਦੁਆਰਾ ਦੂਖਨਿਵਾਰਨ ਸਾਹਿਬ ਗੁਰਦੁਆਰਾ ਮੋਤੀ ਬਾਗ ਸਾਹਿਬ ਅਤੇ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਆਉਂਦੇ ਹਨ ਅਤੇ ਕਾਲੀ ਦੇਵੀ ਮੰਦਰ ਵੀ ਹੈ ਗੁਰਦੁਆਰਾ ਦੂਖਨਿਵਾਰਨ ਸਾਹਿਬ ਦੀ ਇਤਿਹਾਸਿਕ ਮਹਾਨਤਾ ਇਹ ਹੈ ਕਿ ਇੱਥੇ ਨੌਵੇਂ ਗੁਰੂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ ਮੋਤ ਗੁਰੂ ਸਾਹਿਬ ਮੋਤੀ ਬਾਗ ਅਤੇ ਬਹਾਦਰਗੜ੍ਹ ਗੁਰਦੁਵਾਰਿਆਂ ਵਿੱਚ ਵੀ ਰਹੇ ਕੁਝ ਸਮਾਂ ਬਿਤਾਇਆ ਉਹਨਾਂ ਨੇ ਅਤੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਬਸੰਤਮੀ ਬਸੰਤ ਪੰਚਮੀ ਮੌਕੇ ਖਾਸ ਤੌਰ 'ਤੇ ਤਿਉਹਾਰ ਇਹ ਮਨਾਇਆ ਜਾਂਦਾ ਹੈ ਅਤੇ ਗੁਰਦੁਆਰਾ ਬਹਾਦਰਗੜ੍ਹ ਵਿਖੇ ਵਿਸਾਖੀ ਦਾ ਤਿਉਹਾਰ ਵਿਸ਼ੇਸ਼ ਤੌਰ 'ਤੇ ਮਨਾਇਆ ਜਾਂਦਾ ਹੈ ਅਤੇ ਮੈਂ ਇਹਨਾਂ ਮੌਕਿਆਂ ਉੱਤੇ ਇਹਨਾਂ ਦਰ ਗੁਰਦੁਆਰਾ ਸਾਹਿਬ ਵਿੱਚ ਦਰਸ਼ਨਾਂ ਲਈ ਜਾਂਦਾ ਰਹਿੰਦਾ ਹਾਂ